ਹੈਲੋ ਸਤਿ ਸ਼੍ਰੀ ਅਕਾਲ ਜੀ ਟਰੈਵਲ ਏਜੰਸੀ ਤੋਂ ਬੋਲਦੇ ਹਾਂ ਹਾਂਜੀ ਅਸੀਂ ਤੁਹਾਨੂੰ ਤੁਹਾਡੇ ਤੋਂ ਨਾ ਕਾਰ ਬੁੱਕ ਕਰਵਾਈ ਸੀ ਬਾਹਰ ਜਾਣਾ ਸੀ ਕਿਤੇ ਘੁੰਮਣ ਲਈ ਅਤੇ ਉਹ ਤੁਹਾਡੇ ਡਰਾਈਵਰ ਨੂੰ ਅਸੀਂ ਟਾਈਮ ਵੀ ਦੱਸਿਆ ਹੋਇਆ ਸੀ ਪਰ ਉਹ ਟਾਈਮ ਨਾਲ਼ ਆਇਆ ਨਹੀਂ ਅਤੇ ਨਾ ਹੀ ਹੁਣ ਕੋਈ ਫ਼ੋਨ ਚੱਕ ਰਿਹਾ ਅਤੇ ਅਸੀਂ ਜਾਣ ਲਈ ਲੇਟ ਹੋ ਰਹੇ ਹਾਂ ਅਤੇ ਦੱਸੋ ਹੁਣ ਅਸੀਂ ਕੀ ਕਰੀਏ ਉਹਦਾ ਕੋਈ ਨੰਬਰ ਦੇ ਦਿਉ ਹੋਰ ਸਾਨੂੰ ਜੇ ਹੈ ਤੁਹਾਡੇ ਕੋਲ ਜਾਂ ਫਿਰ ਤੁਸੀਂ ਕਾਲ ਕਰਕੇ ਪੁੱਛੋ ਉਹਨੂੰ ਅਤੇ ਕਿਉਂ ਨਹੀਂ ਆਇਆ ਅਤੇ ਕਿਉਂ ਫ਼ੋਨ ਕਿਉਂ ਨਹੀਂ ਚੱਕ ਰਿਹਾ ਉਹ ਤੁਸੀਂ ਸਾਨੂੰ ਜਲਦੀ ਪਤਾ ਕਰਕੇ ਦੱਸੋ ਅਸੀਂ ਜਾਣ ਲਈ ਲੇਟ ਹੋ ਰਹੇ ਹਾਂ ਅਸੀਂ ਸਵੇਰੇ ਜਲਦੀ ਨਿਕਲਣਾ ਸੀ ਅਤੇ ਹੁਣ ਟਾਈਮ ਵੀ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਅਤੇ ਆਪਣੇ ਡਰਾਈਵਰ ਨੂੰ ਜਲਦੀ ਕਾਲ ਕਰਕੇ ਭੇਜੋ ਸਾਡੇ ਕੋਲ